ਸਾਡੇ ਰਾਜ ਵਿੱਚ ਕਈ ਤਿਉਹਾਰ ਬੜੀ ਧੂਮਧਾਮ ਨਾਲ ਮਨਾਏ ਜਾਂਦੇ ਆ ਪਹਿਲੀ ਵਿਸਾਖੀ ਬੜੀ ਧੂਮਧਾਮ ਨਾਲ ਮਨਾਉਂਦੇ ਆ ਸੰਗਤ ਕਾਫੀ ਇਕੱਠੀ ਹੁੰਦੀ ਹੈ ਗੁਰੂ ਘਰ ਦਮਦਮਾ ਸਾਹਿਬ ਕਾਫੀ ਸੰਗਤ ਇਕੱਠੀ ਹੁੰਦੀ ਆ ਅਤੇ ਮੇਲਾ ਭਰਦਾ ਉੱਥੇ ਪੂਰਾ ਗੁਰੂ ਘਰ ਮੱਥਾ ਟੇਕਦੇ ਆ ਅਤੇ ਉੱਥੋਂ ਦੀਆਂ ਆਈਆਂ ਹੋਈਆਂ ਸੰਗਤਾਂ ਲੰਗਰ ਪਾਣੀ ਛਕਦੀਆਂ ਹੈਗੀਆਂ ਬਹੁਤ ਆਨੰਦ ਆਉਂਦਾ ਹੈਗਾ ਜਾ ਕੇ ਮੇਲਾ ਦੇਖਣ ਨੂੰ ਮਿਲਦਾ ਝੂਲੇ ਵਗੈਰਾ ਹੁੰਦੇ ਆ ਉੱਥੇ ਘੋੜ ਸਵਾਰੀ ਹੁੰਦੀ ਆ ਅਤੇ ਬਾਕੀ ਸਾਡੇ ਇੱਥੇ ਗੁਰਪੁਰਬ ਵੀ ਬਹੁਤ ਕਿਉਂਕਿ ਸਾਡੇ ਗੁਰੂਆਂ ਦਾ ਦਿਨ ਹੁੰਦਾ ਉਸ ਦਿਨ ਅਤੇ ਉਹ ਬੜੇ ਹੀ ਸੰਗਤ ਗੁਰੂ ਘਰਾਂ 'ਚ ਜਾਂਦੀ ਆ ਜਿੱਥੇ ਗੁਰੂ ਘਰ ਬਣੇ ਆ ਨੇੜੇ ਨੇੜਲੇ ਗੁਰੂ ਘਰਾਂ 'ਚ ਜਾਂਦੀ ਆ ਉੱਥੇ ਮੱਥਾ ਟੇਕਦੇ ਆ ਸ਼ਬਦ ਕੀਰਤਨ ਸੁਣਦੇ ਆ ਅਤੇ ਪਾਠ ਵਗੈਰਾ ਚਲ ਚਲਦੇ ਕਈ ਦਿਨ ਚਲਦੇ ਪਾਠ ਚਲਦੇ ਆ ਉਹਨਾਂ ਦਾ ਭੋਗ ਪੈਂਦਾ ਹੈਗਾ ਅਤੇ ਲੰਗਰ ਪਾਣੀ ਛਕਾਇਆ ਜਾਂਦਾ ਸੰਗਤਾਂ ਨੂੰ ਉਹਨਾਂ ਸੰਗਤਾਂ ਨੂੰ ਅਤੇ ਬੜਾ ਵੀ ਸੇਵਾ ਕਰਕੇ ਬਹੁਤ ਸਾਨੂੰ ਆਨੰਦ ਆਉਂਦਾ ਹੈਗਾ ਲੋਹੜੀ ਵਗੈਰਾ ਮਨਾਉਂਦੇ ਆ ਲੋਹੜੀ 'ਤੇ ਆਂਢ ਗਆਂਢ ਦੇ ਰਿਸ਼ਤੇਦਾਰ ਇਕੱਠੇ ਹੁੰਦੇ ਜੇ ਕੋਈ ਬੱਚਾ ਹੋਇਆ ਤਾਂ ਉਹਦੀ ਫਸਟ ਲੋਹੜੀ 'ਤੇ ਆ ਰਿਸ਼ਤੇਦਾਰ ਵੀ ਆਉਂਦੇ ਆਂਢ ਗੁਆਂਢ ਇਕੱਠਾ ਹੁੰਦਾ ਅਤੇ ਉੱਥੇ ਬੜਾ ਮਤਲਬ ਲੋਹੜੀ 'ਤੇ ਬੈਠ ਕੇ ਬੜਾ ਆਨੰਦ ਲੈਂਦੇ ਆ ਲੋਕ ਅਤੇ ਤਕਰੀਬਨ ਦੀਵਾਲੀ ਵੀ ਮਨਾਉਂਦੇ ਆ ਪਟਾਕੇ ਚਲਾਏ ਜਾਂਦੇ ਆ ਦੀਵਾਲੀ 'ਤੇ ਅਤੇ ਮਠਿਆਈਆਂ ਵੰਡੀਆਂ ਰਿਸ਼ਤੇਦਾਰਾਂ 'ਚ ਮਿਠਾਈਆਂ ਦਿੰਦੇ ਆਂ ਯਾਰਾਂ ਦੋਸਤਾਂ ਨੂੰ ਮਿਠਾਈਆਂ ਦੇ ਕੇ ਆਉਂਦੇ ਆ ਬੱਚਿਆਂ ਲਈ ਸ਼ੋਪਿੰਗ ਕਰਦੇ ਆ ਘਰ ਸਜਾਏ ਜਾਂਦੇ ਘਰ ਦੀ ਸਫਾਈ ਕੀਤੀ ਜਾਂਦੀ ਹੈ ਬਹੁਤ ਆਨੰਦ ਲਿਆ ਜਾਂਦਾ ਘਰ ਸਜਾਏ ਜਾਂਦੇ ਆ ਦੀਪਮਾਲਾ ਲਾਈ ਜਾਂਦੀ ਆ ਅਤੇ ਬੱਚਿਆਂ ਨੂੰ ਨਵੇਂ ਕੱਪੜੇ ਸਾਰਾ ਕੁਛ ਲੈ ਕੇ ਦਿੱਤਾ ਜਾਂਦਾ ਬਹੁਤ ਅਨੰਦ ਆਉਂਦਾ